ਟੈਕਨੋਲੋਜੀ ਦੇ ਕਾਰਨ ਬਹੁਤ ਹੀ ਸਾਰੇ ਜਿਹੜੇ ਹੈ ਬਦਲਾਵ ਆਏ ਹਨ ਜਿਵੇਂ ਕਿ ਪਹਿਲਾਂ ਦੇ ਸਮੇਂ ਵਿੱਚ ਲੋਕ ਇਕੱਠੇ ਬਹਿ ਕੇ ਆਪਸ ਵਿੱਚ ਗੱਲਾਂ ਮਾਰਦੇ ਹੁੰਦੇ ਸੀ ਬਾਹਰ ਸੈਰ 'ਤੇ ਜਾਂਦੇ ਹੁੰਦੇ ਸੀਗੇ ਘੁੰਮਦੇ ਫਿਰਦੇ ਸੀ ਪਰ ਅੱਜ ਕੱਲ੍ਹ ਟੈਕਨੋਲੋਜੀ ਦੇ ਕਾਰਨ ਜਿਹੜੇ ਲੋਕ ਹੈ ਘਰਾਂ ਦੇ ਵਿੱਚ ਬੈਠੇ ਹੀ ਗੇਮਾਂ ਖੇਡਦੇ ਰਹਿੰਦੇ ਹਨ ਵੀਡਿਓਜ ਦੇਖਦੇ ਰਹਿੰਦੇ ਹਨ ਅੱਜ ਕੱਲ੍ਹ ਬੱਚੇ ਆਪਣੀ ਪੜ੍ਹਾਈ ਨੂੰ ਛੱਡ ਕੇ ਜ਼ਿਆਦਾ ਜਿਹੜਾ ਅਪਣਾ ਟਾਇਮ ਹੈ ਉਹ ਫੋਨਾਂ 'ਤੇ ਹੀ ਬਤੀਤ ਕਰਦੇ ਹਨ ਜਿਵੇਂ ਕਿ ਚਾਰ ਲੋਕ ਇਕੱਠੇ ਬੈਠੇ ਹੈ ਤਾਂ ਉਹ ਚਾਰਾਂ ਦਾ ਧਿਆਨ ਹੀ ਆਪਣੇ ਫੋਨ ਦੇ ਵਿੱਚ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਫਿੱਕ ਪੈ ਚੁੱਕੀ ਹੈ ਕੁੰ ਕਿਉਂਕਿ ਸਾਰਾ ਦਿਨ ਲੋਕ ਆਪਣੇ ਫੋਨਾਂ 'ਤੇ ਹੀ ਲੱਗੇ ਰਹਿੰਦੇ ਹਨ ਆਪਣਿਆਂ ਲਈ ਕੋਈ ਵੀ ਸਮਾਂ ਨਹੀ ਕੱਢਦਾ